ਸੈਲਾਨੀ ਸੈਲਾਨੀਆਂ ਨੂੰ ਆਉਣ ਵਾਲੀਆਂ ਜੇ ਚੁਣੌਤੀਆਂ ਦਾ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਇੱਥੇ ਪੰਜਾਬ ਦੇ ਵਿੱਚ ਆਪਾਂ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਭਾਸ਼ਾ ਦੀ ਬੜੀ ਦਿੱਕਤ ਆਉਂਦੀ ਆ ਜਿੱਦਾਂ ਕਈ ਸੈਲਾਨੀ ਜਿਹੜੇ ਬਾਹਰਲੇ ਮੁਲਕ ਤੋਂ ਇੱਥੇ ਆਉਂਦੇ ਆ ਜਾਂ ਬਾਹਰਲੇ ਕਈ ਆਪਾਂ ਰਾਜਾਂ ਤੋਂ ਗੱਲ ਕ ਗੱਲ ਕਰੀਏ ਰਾਜਾਂ ਤੋਂ ਇੱਥੇ ਕਈ ਆਉਂਦੇ ਨੇ ਤਾਂ ਪਹਿਲੀ ਗੱਲ ਤਾਂ ਮਤਲਬ ਪੰਜਾਬੀ ਮਤਲਬ ਉਹਨਾਂ ਨੂੰ ਬੋਲ ਬੋਲਣ ਸਮਝਣ ਮਤਲਬ ਬੋਲਣ ਸਮਝਣ 'ਚ ਬੜੀ ਦਿੱਕਤ ਆਉਂਦੀ ਹੈ ਕਿਉਂਕਿ ਉਹ ਉਹਨਾਂ ਦੀ ਤਾਂ ਇਹ ਸਥਾਨਕ ਭਾਸ਼ਾ ਨਹੀਂ ਹੈਗੀ ਨਾ ਤਾਂ ਕਰਕੇ ਉਹਨਾਂ ਨੂੰ ਵਿਚਰਨ ਦੇ ਵਿੱਚ ਇਹ ਬੜੀ ਦਿੱਕਤ ਆਉਂਦੀ ਆ ਦੂਸਰੀ ਆਪਾਂ ਜੇ ਗੱਲ ਕਰੀਏ ਤਾਂ ਗੱਲ ਹੈਗੀ ਹੈ ਮੌਸਮ ਦੀ ਤਾਂ ਮੌਸਮ ਜਿਵੇਂ ਹੁਣ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਇੱਥੇ ਬਹੁਤ ਖੁਸ਼ਕ ਚੱਲ ਰਿਹਾ ਹੈਗਾ ਤਾਂ ਹੁਣ ਜੇ ਬਾਹਰਲੇ ਮੁਲਕ ਤੋਂ ਕੋਈ ਸੈਲਾਨੀ ਇੱਥੇ ਆਇਆ ਹੋਵੇ ਤਾਂ ਉਹਨਾਂ ਲਈ ਤਾਂ ਇਹ ਬਹੁਤ ਵੱਡਾ ਇੱਕ ਆਪਾਂ ਕਹਿ ਲਈਏ ਵੀ ਚੈਲੇਂਜ ਹੋਊਗਾ ਤਾਂ ਮੌਸਮ ਬਹੁਤ ਖਰਾਬ ਹੈ ਤਾਂ ਅੱਜ ਕੱਲ੍ਹ ਇੱਥੇ ਹੁਣ ਕਈ ਆਪਾਂ ਉਹਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਉੱਥੇ ਮੀਂਹ ਐਨਾ ਜ਼ਿਆਦਾ ਪੈ ਰਿਹਾ ਤਾਂ ਬਾਕੀ ਉੱਥੇ ਉਹ ਸਿਸਟਮ ਇੰਨਾ ਵਧੀਆ ਨਹੀਂ ਹੈਗਾ ਡਰੇਨੇਜ ਸਿਸਟਮ ਐਨਾ ਵਧੀਆ ਨਹੀਂ ਹੈਗਾ ਤਾਂ ਇਹੋ ਜਿਹੀਆਂ ਕਈ ਦਿੱਕਤਾਂ ਹੈਗੀਆਂ ਵੀ ਜਿਹਨਾਂ ਦਾ ਸਾਹਮਣਾ ਕਰ ਸਾਹਮਣਾ ਕਰਨਾ ਪੈਂਦਾ ਹੈਗਾ